ਸਤਿ ਸ਼੍ਰੀ ਅਕਾਲ ਜੀ ਮੈਨੂੰ ਬਚਪਨ ਤੋਂ ਹੀ ਖਾਣਾ ਬਣਾਉਣ ਦਾ ਬਹੁਤ ਸ਼ੌਕ ਹੈ ਜਦੋਂ ਮੈਂ ਬਚਪਨ ਵਿੱਚ ਸੀਗੀ ਅਤੇ ਮੈਂ ਮਿੱਠੀ ਰੋਟੀ ਬਣਾਉਂਦੀ ਹੁੰਦੀ ਸੀ ਮੇਰੇ ਦਾਦੀ ਨੂੰ ਮੇਰੇ ਹੱਥ ਦੀ ਮਿੱਠੀ ਰੋਟੀ ਬੜੀ ਹੀ ਪਸੰਦ ਸੀ ਅਤੇ ਮੈਂ ਮਿੱਠੀ ਰੋਟੀ ਬਣਾ ਕੇ ਆਪਣੇ ਦਾਦੀ ਨੂੰ ਦਿੰਦੀ ਹੁੰਦੀ ਸੀ ਅਤੇ ਉਹ ਬੜੇ ਹੀ ਚਾਵਾਂ ਨਾਲ ਖਾਂਦੇ ਸੀਗੇ ਫਿਰ ਹੌਲੀ ਹੌਲੀ ਮੈਂ ਆਪਣੇ ਮੰਮਾ ਜੀ ਦੇ ਨਾਲ ਰਸੋਈ ਦੇ ਵਿੱਚ ਹੱਥ ਵਟਾਉਣਾ ਸ਼ੁਰੂ ਕੀਤਾ ਅਤੇ ਉਹਨਾਂ ਨਾਲ ਰਲ ਕੇ ਰੋਜ਼ ਕੰਮ ਕਰਾਉਂਦੀ ਸੀ ਅਤੇ ਉਹਨਾਂ ਕੋਲੋਂ ਸਬਜ਼ੀ ਅਤੇ ਬੜਾ ਹੀ ਸਵਾਦਿਸ਼ਟ ਖਾਣਾ ਬਣਾਉਣਾ ਸਿੱਖਿਆ ਫਿਰ ਇੱਕ ਦਿਨ ਉਸ ਨੂੰ ਮੈਂ ਖੁਦ ਬਣਾਉਣ ਬਣਾਇਆ ਅਤੇ ਬੜਾ ਹੀ ਸਵਾਦ ਬਣਿਆ ਫਿਰ ਮੈਨੂੰ ਖਾਣਾ ਪਕਾਉਣ ਵਾਲੇ ਸ਼ੈਫ ਬਣਾਉਣ ਦਾ ਸ਼ੌਕ ਪੈ ਗਿਆ ਇਸ ਗੱਲ ਉੱਤੇ ਮੈਂ ਆਪਣੇ ਮੰਮਾ ਪਾਪਾ ਨਾਲ ਗੱਲ ਕੀਤੀ ਪਹਿਲਾਂ ਤਾਂ ਉਹਨਾਂ ਨੇ ਗੁੱਸਾ ਕੀਤਾ ਕਿ ਤੂੰ ਖਾਣਾ ਬਣਾਉਣ ਵਾਲਾ ਸ਼ੈਫ ਨਹੀਂ ਬਣੇਗੀ ਕਿਉਂਕਿ ਕੁੜੀਆਂ ਜਦੋਂ ਇਹ ਕੰਮ ਕਰਦੀਆਂ ਹਨ ਤਾਂ ਸਮਾਜ ਵਿੱਚ ਉਹਨਾਂ ਦੀ ਇੱਜ਼ਤ ਨਹੀਂ ਰਹਿੰਦੀ ਲੋਕ ਉਹਨਾਂ ਨੂੰ ਚੰਗਾ ਨਹੀਂ ਸਮਝਦੇ ਫਿਰ ਮੈਂ ਇਹ ਗੱਲ ਆਪਣੇ ਚਾਚਾ ਜੀ ਨਾਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਜੇ ਤੂੰ ਇਸ ਨੂੰ ਆਪਣਾ ਪੇਸ਼ਾ ਬਣਾਉਣਾ ਚਾਹੁੰਦੀ ਹਾਂ ਤਾਂ ਤੂੰ ਇਹ ਕੰਮ ਕਰ ਲੈ ਅਸੀਂ ਤੇਰਾ ਸਾਥ ਦੇਵਾਂਗੇ ਅਤੇ ਹੁਣ ਮੈਂ ਇੱਕ ਬਹੁਤ ਹੀ ਚੰਗੀ ਸ਼ੈਫ ਹਾਂ ਅਤੇ ਮੈਂ ਬੜਾ ਹੀ ਵਧੀਆ ਅਤੇ ਸਵਾਦਿਸ਼ਟ ਖਾਣਾ ਬਣਾਉਂਦੀ ਹਾਂ ਧੰਨਵਾਦ